ਕੋਈ ਵੀ ਪਕਵਾਨ ਬਣਾਈਏ ਤਾਂ ਉਹਦੇ ਸਵਾਦ ਵਧਾਉਣ ਵਾਸਤੇ ਉਹਦੇ ਅੰਦਰ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਨੇ ਜਿਹੜੇ ਆਮ ਤੌਰ 'ਤੇ ਮਸਾਲੇ ਪਾਏ ਜਾਂਦੇ ਨੇ ਇਸ ਤੋਂ ਇਲਾਵਾ ਕਈ ਦੁਰਲੱਭ ਸਮੱਗਰੀਆਂ ਹੈਗੀਆਂ ਜਿਹੜੀ ਕਿ ਆਪਾਂ ਇਸਤੇਮਾਲ ਕਰਕੇ ਵਿਅੰਜਨ ਦਾ ਸਵਾਦ ਵਧਾ ਸਕਦੇ ਹਾਂ ਆਮ ਤੌਰ 'ਤੇ ਖਾਧੀ ਜਾਣ ਵਾਲੀ ਦਾਲ 'ਤੇ ਲੋਕ ਦੇਸੀ ਘਿਉ ਵਿੱਚ ਜ਼ੀਰਾ ਪਾ ਕੇ ਤੜਕਾ ਲਾ ਦਿੰਦੇ ਹੈ ਇਹਦੀ ਥਾਂ ਆਪਾਂ ਦੇਸੀ ਘਿਉ ਦੇ ਅੰਦਰ ਸ਼ਾਹੀ ਜ਼ੀਰਾ ਇਸਤੇਮਾਲ ਕਰੀਏ ਤੇਜ਼ ਪੱਤਾ ਇਸਤੇਮਾਲ ਕਰੀਏ ਲੌਂਗ ਵੱਡੀ ਇਲਾਇਚੀ ਇਹਨੂੰ ਚੰਗੀ ਤਰ੍ਹਾਂ ਗੈਸ 'ਤੇ ਗਰਮ ਕਰਕੇ ਦਾਲ ਦੇ ਕੂਕਰ ਦੇ ਅੰਦਰ ਤੜਕਾ ਪਾ ਕੇ ਉਹਨੂੰ ਬੰਦ ਕਰ ਦੇਈਏ ਤਾਂ ਇਹਦਾ ਸਵਾਦ ਕਈ ਗੁਣਾ ਵੱਧ ਜਾਊਗਾ